ਚਿੱਤਰਕਾਰੀ ਦੀ ਕਲਾਸ ਜਾਂ ਵਰਕਸ਼ੋਪ ਵਿੱਚ ਵੱਖ ਵੱਖ ਚਿੱਤਰਕਾਰ ਅਤੇ ਵੱਖ ਵੱਖ ਉਹਨਾਂ ਦੀਆਂ ਰਚਨਾਵਾਂ ਕਲਾਵਾਂ ਦਾ ਬਾਰੇ ਪਤਾ ਚੱਲਦਾ ਹੈ ਅਤੇ ਵੱਖ ਆਪਣੇ ਤੋਂ ਵੱਧ ਉਮਰ ਦੇ ਅਤੇ ਐਕਸਪੀਰੀਅੰਸ ਬੰਦਿਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਤੋਂ ਅਸੀਂ ਬਹੁਤ ਹੀ ਜ਼ਿਆਦਾ ਪ੍ਰੇਰਨ ਪ੍ਰੇਰਨਾ ਲੈਂਦੇ ਹਾਂ ਅਤੇ ਉਹਨਾਂ ਦੀਆਂ ਕਲਾਵਾਂ ਕੀਤੀਆਂ ਹੋਈਆਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਜ਼ਿੰਦਗੀ ਵਿੱਚ ਵੀ ਯੂਸ ਕਰ ਸਕਦੇ ਹਾਂ ਜਿਸ ਦੇ ਨਾਲ਼ ਬਹੁਤ ਜ਼ਿਆਦਾ ਸਾਨੂੰ ਲਾਭ ਹੁੰਦਾ ਹੈ ਅਤੇ ਸਾਨੂੰ ਆਪਣੇ ਭਵਿੱਖ ਵਿੱਚ ਕਿਵੇਂ ਕਿੱਦਾਂ ਕੀ ਕਰਨਾ ਕਿੱਥੇ ਤੁਸੀਂ ਗਲਤ ਹੋ ਕਿਵੇਂ ਤੁਹਾਨੂੰ ਚਲਣਾ ਚਾਹੀਦਾ ਹੈ ਇਹ ਸਾਨੂੰ ਸਭ ਇੱਕ ਕਲਾਸ ਵਿੱਚ ਆਪਣੇ ਨਾਲ਼ ਦੇ ਸਟੂਡੈਂਟਸ ਨੂੰ ਦੇਖ ਕੇ ਸਿੱਖਣ ਨੂੰ ਮਿਲਦਾ ਹੈ ਜੋ ਵੀ ਸਾਡੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ ਇਸ ਦੇ ਨਾਲ਼ ਸਾਡੀ ਅੱਗੇ ਦੀ ਜ਼ਿੰਦਗੀ ਵਿੱਚ ਬਹੁਤ ਹੀ ਸੌਖਾ ਰਸਤਾ ਬਣ ਜਾਂਦਾ ਹੈ ਜਿਸ ਦੇ ਨਾਲ਼ ਅਸੀਂ ਆਪਣਾ ਅਗੇ ਪੈਸ਼ਨ ਅੱਗੇ ਵਧਾ ਸਕਦੇ ਹਾਂ ਅਤੇ ਸਾਨੂੰ ਹਰੇਕ ਵਰਕਸ਼ੋਪ ਵਿੱਚੋਂ ਬਹੁਤ ਹੀ ਵੱਖ ਵੱਖ ਕਲਾਵਾਂ ਦੇਖਣ ਨੂੰ ਮਿਲਦੀਆਂ ਹਨ ਵੱਖ ਵੱਖ ਆਕ੍ਰਿਤੀਆਂ ਦੇਖਣ ਨੂੰ ਮਿਲਦੀਆਂ ਹਨ ਅਤੇ ਹਰ ਰੋਜ਼ ਇੱਕ ਨਾ ਇੱਕ ਚੀਜ਼ ਸਿੱਖਣ ਨੂੰ ਮਿਲਦੀ ਹੈ ਜੋ ਕਿ ਸਾਡੀ ਅਗਲੀ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਲਾਭਦਾਇਕ ਸਿੱਧ ਹੋ ਸਕਦੀ ਹੈ